ਹਾਂ ਤੂੰ ਦੱਸ ਕਹਿੰਦਾ ਕੁਛ ਨਹੀਂ ਬਸ ਵਿਹਲਾ ਬੈਠਿਆ ਤੂੰ ਦੱਸ ਨਾ ਨਾ ਬਸ ਮੋਬਾਈਲ ਹੀ ਦੇਖ ਰਿਹਾ ਸੀ ਵਿਹਲਾ ਬੈਠਾ ਟਾਈਮ ਪਾਸ ਵੀ ਨਹੀਂ ਹੋ ਰਿਹਾ ਸੀ ਵਿਹਲੇ ਹੋ ਗਏ ਨੇ ਪਲੱਸ ਟੂ ਹੋ ਗਈ ਆ ਕੀ ਕਰੀਏ ਵਿਹਲੇ ਹਾਂ ਹੁਣ ਆਪਾਂ ਅੱਗੇ ਉਹੀ ਦੇਖਦੇ ਹਾਂ ਬੀਕੌਮ ਸੋਚਦੇ ਹਾਂ ਹਲੇ ਤਾਂ ਫਿਲਹਾਲ ਤਾਂ ਮੈਂ ਤੂੰ ਦੱਸ ਕੀ ਕਰਨਾ ਬੀਟੈਕ ਬੀਟੈਕ ਹਾਂ ਬੀਟੈਕ ਵਧੀਆ ਹਾਂ ਮੈਂ ਵੀ ਬੀਕੋਮ ਹੀ ਸੋਚੀ ਆ ਮੈਂ ਕਮਰਸ ਕਾਊਟਿੰਗ ਦੇ ਵਿੱਚ ਹੀ ਸੋਚਿਆ ਵੈਸੇ ਤਾਂ ਮੈਂ ਤਾਂ ਤਾਂ ਹਾਂ ਉਹ ਤਾਂ ਜਦੋਂ ਬਾਰਵੀਂ ਦਾ ਰਿਜ਼ਲਟ ਆਊਂਗਾ ਫਿਰ ਉਸ ਹਿਸਾਬ ਨਾਲ ਹੀ ਪਤਾ ਲੱਗਣਾ ਸਾਨੂੰ ਹਲੇ ਹਾਲੇ ਤਾਂ ਆਪਾਂ ਫਸੇ ਪਏ ਹਾਂ ਹਲੇ ਤਾਂ ਫਸੇ ਪਹਿਲਾਂ ਰਿਜ਼ਲਟ ਆਊਂਗਾ ਫਿਰ ਉਹ ਤੋਂ ਬਾਅਦ ਐਡਮੀਸ਼ਨ ਸ਼ੁਰੂ ਹੋਣੀ ਫਿਰ ਕੋਲਿਜ ਲੱਭਣੇ ਪੈਣੇ ਆ ਫਿਰ ਪਹਿਲੇ ਉਹ ਤਾਂ ਸ ਸੋਚਣਾ ਪੈਣਾ ਕਾਲਜ ਵੀ ਹਾਂ ਬੀਟੈਕ ਮੇਰੀ ਤਾਂ ਮੇਰੇ ਖਿਆਲ ਸਰਵਾਨੰਦ ਕਾਲਜ ਹੈਗਾ ਇੱਕ ਹੁਸ਼ਿਆਰਪੁਰ ਉਹ ਆਉਂਦਾ ਵੀ ਪੰਜਾਬ ਯੂਨੀਵਰਸਿਟੀ ਦੇ ਅੰਡਰ ਆ ਉਹ ਵਧੀਆ ਨਾ ਹਾਂ ਸਰਵਾਨੰਦ ਵਧੀਆ ਬੀਕੋ ਬੀਟੈਕ ਲਈ ਅ ਬੀਟੈਕ ਲਈ ਹਾਂ ਉਹ ਨੰਬਰ ਵਿੱਚ ਅਤੇ ਜੇ ਈ ਲੈਂਦੇ ਮੇਰੇ ਹਿਸਾਬ ਨੂੰ ਹਾਂ ਤੈਨੂੰ ਜੇ ਈ ਦੇ ਪੇਪਰ ਦੇਣਾ ਪੈਣਾ ਅਗਰ ਤੇਰੇ ਮਾਕਸ ਵਧੀਆ ਆਏ ਤਾਂ ਪੋਜ਼ਿਸ਼ਨ ਕਿਉਂਕਿ ਜੇ ਲਿਸਟ ਨਿਕਲਦੀ ਆ ਉਹਦੀ ਲਿਸਟ ਆਉਣੀ ਪੈਂਦੀ ਆ ਪੂਰੀ ਫਿਰ ਮਿਲਣੀ ਨੰਬਰਾਂ ਦੇ ਬੇਸ ਹਾਂ ਬਾਰਵੀਂ ਵੀ ਨਾਲ ਬਾਰਵੀਂ ਨੰਬਰ ਵੀ ਮੈਟਰ ਕਰੂੰਗੇ ਅਤੇ ਜੇ ਈ ਦੇ ਨੰਬਰ ਵੀ ਮੈਟਰ ਕਰੂੰਗੇ ਹਾਂ ਮੈਂ ਵੀ ਇਹੀ ਜੇ ਸੋਚਦਾ ਮੈਂ ਤਾਂ ਬੀਕੌਮ ਵੀ ਸੋਚਿਆ ਸੀ ਨਾਲ ਗੌਰਮੈਂਟ ਕੋਲਜ ਦੇਖਦਾ ਅਪਲਾਈ ਕਰੁੰਗਾ ਉੱਥੇ ਨੰਬਰ ਵਧੀਆ ਆ ਗਏ ਬਾਰਵੀਂ ਦੇ ਤਾਂ ਐਡਮਿਸ਼ਨ ਮਿਲ ਜੂੰਗੀ ਸਹੀ ਹੈ ਸੋ ਕਾਲਜ ਤਾਂ ਵਧੀਆ ਉੱਤੋਂ ਫੀਸ ਵੀ ਘੱਟ ਹੋਣੀ ਗੌਰਮੈਂਟ ਕੋਲਜ ਤਾਂ ਹਾਂ ਸਰਵਾਨੰਦ ਵੀ ਘੱਟ ਹੀ ਹੋਣੀ ਵੈਸੇ ਬੀਟੈਕ ਅਗਰ ਉਹ ਮਾਸਕ ਨਾਲ ਸਕੋਲਰਜੀ ਵਗੈਰਾ ਵੀ ਮਿਲ ਜੂਗੀ ਨਾ ਇਹ ਵੀ ਹੁਣ ਹਾਂ ਇਹ ਵੀ ਆ ਚੱਲ ਇਹੀ ਆ ਇਹੀ ਆ ਭਗਵਾਨ ਨੂੰ ਇਹੀ ਆ ਕਿ ਸਾਡੇ ਮਾਕਸ ਵਧੀਆ ਆਵੇ ਦੋਨਾਂ ਦੇ ਵਧੀਆ ਮਿਲ ਜਾਵੇ ਕਾਲਜ ਐਡਮਿਸ਼ਨ ਇਕੱਠੇ ਹਾਂ ਪਰ ਸਰਵਾਨੰਦ ਸਰਵਾਨੰਦ ਮੈਂ ਆ ਜਾਣਾ ਸਰਵਾਨੰਦ ਬੀਕੌਮ ਹੈ ਨਹੀਂ ਤਾਂ ਮੈਂ ਬੀਕੋਮ ਸੋਚ ਲਈ ਸਰਵਾਨੰਦ ਬੀਕੌਮ ਹੈ ਨਹੀਂ ਪਰ ਮਨਾ ਸਰਵਾਨੰਦ ਬੀਕੌਮ ਹੈ ਨਹੀਂ ਹੈਗੀ ਆ ਉੱਥੇ ਬਸ ਐਲ ਐਲ ਬੀ ਆ ਗਵਰਮੈਂਟ ਪੋਸਟਾਂ ਮੇਨ ਤਾਂ

ਹਾਂ ਬਸ ਕੱਲ੍ਹ ਦੇਖਦੇ ਹਾਂ ਕੀ ਕਰੀਏ ਫਿਰ ਉਹ ਤਾਂ ਬਾਰਵੀਂ ਦੇ ਨੰਬਰ 'ਤੇ ਹਾਂ ਉਹੀ ਤੇਰੇ ਜੇ ਈ ਦਾ ਮੈਟਰ ਕਰੂਗਾ ਰਿਜ਼ਲਟ ਮੇਰਾ ਬਾਰਵੀਂ ਦਾ ਕੋਈ ਨਹੀਂ ਕਰਦੇ ਹਾਂ ਦੇਖਦੇ ਹਾਂ ਉਹ ਨੰਬਰ ਆਉਣ ਦੇ ਫਿਰ ਕਰਦੇ ਹਾਂ ਗੱਲ ਚਲ ਠੀਕ ਆ ਚਲ ਠੀਕ ਆ ਮਿਲਦੇ ਹਾਂ ਠੀਕ ਆ ਓਕੇ ਬਾਏ